ਹਾਂਜੀ ਮੈਮ ਨਮਸਤੇ ਮੈਮ ਤੁਸੀਂ ਖੁਸ਼ਨੂਰ ਦੇ ਪੇਰੈਂਟਸ ਬੋਲਦੇ ਹੋ ਹਾਂਜੀ ਮੈਮ ਮੈਂ ਸੈਕਰਡ ਹਾਰਟ ਸਕੂਲ ਤੋਂ ਬੋਲਦੀ ਸੀਗੀ ਉਹਨਾਂ ਦੀ ਟੀਚਰ ਬੱਚਿਆਂ ਦਾ ਹੁਣੀ ਫਸਟ ਯੂਨਿਟ ਟੈਸਟ ਹੋਏ ਸੀ ਮੈਂ ਉਹਦੇ ਬਾਰੇ ਤੁਹਾਨੂੰ ਰਿਪੋਰਟ ਦੇਣੀ ਸੀ ਬੱਚਿਆਂ ਦੀ ਹਾਂਜੀ ਮੈਮ ਖੁਸ਼ਨੂਰ ਇਸ ਵਾਰ ਪੇਪਰਾਂ ਦੇ ਵਿੱਚ ਵਧੀਆ ਨੰਬਰ ਆਏ ਨੇਗੇ ਪਰ ਮੈਥ ਦੇ ਵਿੱਚ ਵੀਕ ਹੈ ਖੁਸ਼ਨੂਰ ਕਾਫੀ ਅਤੇ ਤੁਸੀਂ ਉਹਦੇ ਵੱਲ ਥੋੜ੍ਹਾ ਧਿਆਨ ਦਿਓ ਬੱਚਿਆਂ ਨੂੰ ਇੱਥੇ ਵੀ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਅਤੇ ਪ੍ਰੋਪਰ ਤਰੀਕੇ ਨਾਲ ਪੜ੍ਹਾਇਆ ਜਾਂਦਾ ਆ ਬੱਚਿਆਂ ਨੂੰ ਬਟ ਫਿਰ ਵੀ ਉਹਦੇ ਮੈਥ ਦੇ ਵਿੱਚ ਥੋੜ੍ਹੀ ਵੀਕ ਹੈ ਅਤੇ ਸਪੋਰਟਸ ਦੇ ਵਿੱਚ ਵੀ ਉਹ ਖੁੱਲ੍ਹ ਕੇ ਪਾਰਟੀਸੀਪੇਟ ਨਹੀਂ ਕਰਦੀ ਤੁਸੀਂ ਇਸ ਗੱਲ ਬਾਰ ਬਾਰੇ ਧਿਆਨ ਦੇਣਾ ਮੈਮ ਵੈਸੇ ਬੱਚਾ ਘਰ ਠੀਕ ਆ ਐਕਟੀਵਿਟੀਜ਼ ਕਰਦੇ ਨੇ ਬੱਚੇ ਹਾਂਜੀ ਬਟ ਮੈਮ ਵੈਸੇ ਉਹ ਸਪੋਰਟਸ ਦੀਆਂ ਐਕਟੀਵਿਟੀਜ਼ ਦੇ ਵਿੱਚ ਘੱਟ ਪਾਰਟੀਸਪੇਟ ਕਰਦੀ ਅਤੇ ਮੈਥ ਦੇ ਵਿੱਚ ਥੋੜ੍ਹਾ ਵੀਕਨੈਸ ਹੈ ਉਹਦੀ ਹਾਂਜੀ ਅ ਹਾਂਜੀ ਮੈਮ ਦਿਨ ਪਰ ਦਿਨ ਬੱਚਾ ਹੈ ਨਾ ਵੀਕ ਹੋਈ ਜਾਂਦਾ ਉਹ ਗੱਲ ਵਧੀਆ ਨਹੀਂ ਲੱਗਦੀ ਹੈਗੀ ਇਸ ਲਈ ਮੈਂ ਤੁਹਾਨੂੰ ਸਪੈਸ਼ਲੀ ਫੋਨ ਕੀਤਾ ਸੀਗਾ ਵੀ ਹੁਣੀ ਬੱਚਿਆਂ ਦੇ ਫਸਟ ਯੂਨੀਟ ਟੈਸਟ ਹੋਏ ਨੇ ਉਹਦੇ ਬਾਰੇ ਤੁਹਾਨੂੰ ਰਿਪੋਰਟ ਦੇ ਦਾਂ ਇੱਕ ਵਾਰ ਖੁਸ਼ਨੂਰ ਦੀ ਹਾਂਜੀ ਹਾਂਜੀ ਮੈਮ ਬਾਕੀ ਸਬਜੈਕਟਾਂ ਦੇ ਵਿੱਚ ਤਾਂ ਵਧੀਆ ਆ ਪਰ ਫਿਰ ਵੀ ਤੁਸੀਂ ਧਿਆਨ ਦਿਆ ਕਰੋ ਬੱਚੇ ਵੱਲ ਤੁਸੀਂ ਮੈਨੂੰ ਲੱਗਦਾ ਸ਼ਾਇਦ ਧਿਆਨ ਕਰ ਦਿੱਤਾ ਨਹੀਂ ਜਾਂਦਾ ਥੋੜ੍ਹਾ ਜਿਹਾ ਪੜ੍ਹਾਈ ਵੱਲ ਥੋੜ੍ਹਾ ਦੇਖਿਆ ਕਰੋ ਹਾਂਜੀ ਹਾਂਜੀ ਮੈਮ ਅਤੇ ਮੈਮ ਇੱਕ ਖੁਸ਼ਨੂਰ ਦੇ ਕਜ਼ਨ ਵੀ ਹੈ ਇੱਥੇ ਹੀ ਮਨਪ੍ਰੀਤ ਹਾਂਜੀ ਮੈਮ ਉਹ ਵੀ ਬੱਚਾ ਥੋੜ੍ਹਾ ਵੀਕ ਹੈ ਪੜ੍ਹਾਈ ਦੇ ਵਿੱਚ ਓਵਰਆਲ ਤਾਂ ਹਾਂਜੀ ਤੁਸੀਂ ਉਹਦੇ ਵੱਲ ਵੀ ਥੋੜ੍ਹਾ ਧਿਆਨ ਦਿਓ ਹਾਂਜੀ ਮੈਮ ਉਹ ਥੋੜ੍ਹਾ ਜਿਹਾ ਹੈਗੇ ਵੀਕ ਨੇਗੇ ਸਟਡੀ ਦੇ ਵਿੱਚ ਇਸ ਲਈ ਥੋੜ੍ਹਾ ਧਿਆਨ ਦਿਓ ਬੱਚਿਆਂ 'ਤੇ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਇਸੇ ਲਈ ਕੋਲ ਕੀਤੀ ਸੀਗੀ ਤੁਹਾਨੂੰ ਵੀ ਤੁਸੀਂ ਬ ਬੱਚਿਆਂ ਦਾ ਥੋੜ੍ਹਾ ਧਿਆਨ ਦੇਵੋ ਅਤੇ ਪੜ੍ਹਾਈ ਵੱਲ ਠੀਕ ਹੈ ਹਾਂ ਓਕੇ